ਹੈਲੋ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਐਸ ਟੂਰਿਸਟ ਸਰ ਤੁਹਾਡੇ ਕੋਲੋਂ ਇਨਫੋਰਮੇਸ਼ਨ ਲੈਣੀ ਸੀਗੀ ਮੈਨੂੰ ਵਰਿੰਦਰ ਬਾਈ ਜੀ ਨੇ ਦੱਸਿਆ ਸੀਗਾ ਟਰਾਂਸਪੋਰਟੇਸ਼ਨ ਬਾਰੇ ਵੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਲੈਣੀ ਤੀ ਪੰਜਾਬ ਤੋਂ ਜੀ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਅੱਛਾ ਜੀ ਤੇ ਸਰ ਬਾਏ ਬੱਸ ਬਾਏ ਬੱਸ ਟਰਾਂਸਪੋਰਟੇਸ਼ਨ ਕਿੰਨਾ ਕੁ ਪੈ ਜਾਂਦਾ

ਹਾਂਜੀ ਸਰ ਹਾਂਜੀ ਹਾਂਜੀ ਸਰ ਕਿੰਨਾ ਕ ਕੋੋਸਟਲੀ ਪੈ ਜਾਂਦਾ ਐ ਇਹ ਅੱਛਾ ਸਰ ਠੀਕ ਐ ਸਰ 'ਤੇ ਸਰ ਹੋਰ ਕਈ ਦਿਕੱਤ ਤਾਂ ਨੀ ਆਉਂਦੀ ਹੈਗੀ ਹਾਂਜੀ ਟਰਾਂਸਪੋਟੇਸ਼ਨ ਵਿੱਚ ਅੱਛਾ ਸਰ ਹਾਂਜੀ ਸਰ ਹਾਂਜੀ ਸਰ ਠੀਕ ਐ ਸਰ ਤੇ

ਠੀਕ ਏ ਸਰ ਤੇ ਸਰ ਮੈਨੂੰ ਵਰਿੰਦਰ ਬਾਈ ਜੀ ਨੇ ਥਡਾ ਨੰਬਰ ਦਿੱਤਾ ਸੀਗਾ ਵੀ ਕਈ ਵੀ ਟਰਾਂਸਪੋਟੇਸ਼ਨ ਦੀ ਪ੍ਰੋਬਲਮ ਪੁੱਛ ਲੀ ਤੇ ਸਰ ਬਾਏ ਏਅਰ ਕਿੰਨਾ ਕ ਖਰਚਾ ਪੈ ਜਾਂਦਾ ਮਤਲਬ ਕੀ ਵੀ ਏਅਰ ਟਰਾਂਸਪੋਟੇਸ਼ਨ ਕਰਨਾ ਹੋਵੇ ਹਾਂਜੀ ਮਤਲਬ ਕਿ ਆ ਬੱਸ ਨਾਲੋਂ ਜ਼ਿਆਦਾ ਪੈਂਦਾ

ਹਾਂਜੀ ਸਰ

ਹਾਂਜੀ ਸਰ ਹਾਂਜੀ ਸਰ

ਠੀਕ ਐ ਸਰ ਹਾਂਜੀ ਠੀਕ ਐ ਸਰ

ਹਾਂਜੀ ਟਰਾਂਸਪੋਟੇਸ਼ਨ ਲਈ ਹਾਂਜੀ ਸਰ ਹਾਂਜੀ ਸਰ

ਹਾਂਜੀ ਹਾਂਜੀ ਸਰ ਹਾਂਜੀ ਸਰ ਠੀਕ ਐ ਸਰ ਠੀਕ ਐ ਸਰ ਠੀਕ ਐ ਸਰ ਬਾਕੀ ਜੇ ਮੈਨੂੰ ਹਰ ਇਨਫੋਰਮੇਸ਼ਨ ਹੋਈ ਤਾਂ ਮੈਂ ਥੋਨੂੰ ਕੰਨਟੈਕਟ ਕਰ ਲੂਗਾ ਮੈਂ ਕਾਲ ਕਰ ਲੂਗਾ ਥੋਨੂੰ ਠੀਕ ਐ ਸਰ ਹਾਂਜੀ ਧੰਨਵਾਦ ਜੀ ਥੋਡਾ